ਵੈਸੇ ਤਾਂ ਅਸੀਂ ਸ਼ਹਿਰੀ ਲੋਕ ਹਾਂ ਪਰ ਅਸੀਂ ਪੇਂਡੂ ਲੋਕ ਦੇ ਅਨੁਭਵ ਬਾਰੇ ਕਾਫੀ ਕੁਛ ਹੱਦ ਤੱਕ ਜਾਣਦੇ ਹਾਂ ਵੈਸੇ ਤਾਂ ਮੇਰਾ ਦੋਸਤ ਵੀ ਪੇਂਡੂ ਹੈ ਪਰ ਮੈਂ ਉਹਦੇ ਬਾਰੇ ਤੁਹਾਨੂੰ ਕੁਛ ਬਤਾਉਣਾ ਚਾਹੁੰਦਾ ਹਾਂ ਉਹਦੀ ਵੀ ਕਾਫੀ ਹੱਦ ਤੱਕ ਪੈਲੀ ਹੈ ਤਾਂ ਪਰ ਮੈਂ ਕਿਸਾਨ ਦੇ ਰੂਪ 'ਚ ਆਪਣੀ ਗੱਲ ਦੱਸਣਾ ਚਾਹੁੰਦਾ ਹਾਂ ਕਿਸਾਨ ਕਈ ਤਰੀਕਿਆਂ ਨਾਲ ਆਪਣੀ ਫਸਲ ਬਚਾ ਕੇ ਰੱਖਦਾ ਹੈ ਕਿਸਾਨ ਨੂੰ ਵੀ ਕਈ ਮੁਸ਼ਕਿਲਾਂ ਦਾ ਕ ਸਾਹਮਣਾ ਕਰਨਾ ਪੈਂਦਾ ਹੈ ਕਿਸਾਨ ਕਿਸਾਨ ਨੂੰ ਆਪਣੀ ਫਸਲ ਬਚਾਉਣ ਲਈ ਹਵਾ ਪਾਣੀ ਤੂਫਾਨ ਆਦਿ ਦਾ ਸਾਹਮਣਾ ਕਰਨਾ ਪੈਂਦਾ ਹੈ ਕਈ ਕਿਸਾਨ ਆਪਣੀ ਕ ਸ ਆਪਣੀ ਫਸਲ ਨੂੰ ਬਚਾਉਣ ਲਈ ਕਾਫੀ ਹੱਦ ਤੱਕ ਕੋਸ਼ਿਸ਼ ਕਰਦੇ ਹਨ ਕੈਮੀਕਲ ਵਗੈਰਾ ਛਿੜਕਦੇ ਹਨ ਜਿਸ ਦੇ ਕਾਰਨ ਉਹਨਾਂ ਦੀ ਖੇਤੀ ਚਲਦੀ ਰਹਿੰਦੀ ਹੈ ਕਿਸਾਨ ਨੂੰ ਆਪਣੇ ਜੀਵਨ 'ਚ ਕਾਫੀ ਹੱਦ ਤੱਕ ਸਾ ਦੁੱਖ ਦਵਾਂ ਸਹਿਣੀਆਂ ਪੈਂਦੀਆਂ ਹਨ ਪਰ ਉਹਨਾਂ ਦਾ ਉਹਨਾਂ ਦਾ ਬੰਦੋਬਸਤ ਵੀ ਉਹਨਾਂ ਨੂੰ ਆਪ ਕਰਨਾ ਚਾਹੀਦਾ ਹੈ ਧੰਨਵਾਦ